ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਨਾ ਤੁਹਾਡੇ ਹਮੇਸ਼ਾ ਕੈਬ ਬੁੱਕ ਕਰਾਉਂਦੀ ਹੁੰਦੀ ਹਾਂ ਅਤੇ ਮੈਨੂੰ ਤੁਹਾਡੇ ਕੈਬ ਦੀ ਕਾਫੀ ਅੱਛੀ ਲੱਗੀ ਹੈ ਅਤੇ ਮੈਂ ਉਹਦੀ ਰੇਟਿੰਗ ਕਰਨਾ ਚਾਹੁੰਦੀ ਹਾਂ ਅਤੇ ਤੁਸੀਂ ਤੁਹਾਡੇ ਮੈਨੂੰ ਡਰਾਈਵਰ ਵੀ ਠੀਕ ਲੱਗਦੇ ਆ ਕਿ ਅੱਛੀ ਤਰ੍ਹਾਂ ਗੱਲ ਕਰਦੇ ਆ ਤੁਸੀਂ ਪੈਸੇ ਵੀ ਕਿਸੇ ਕੋਲ ਜ਼ਿਆਦਾ ਨਹੀਂ ਲੈਂਦੇ ਅਤੇ ਨਾਲੇ ਥੋੜ੍ਹਾ ਵੇਟ ਵੀ ਕਰ ਲੈਂਦੇ ਹੋ ਅਤੇ ਇਸ ਕਰਕੇ ਮੈਂ ਚਾਹੁੰਦੀ ਐ ਕਿ ਤੁਸੀਂ ਮੈਨੂੰ ਆਪਣੇ ਮੈਂ ਉਹ ਰੇਟਿੰਗ ਕਰਨਾ ਚਾਹੁੰਦੀ ਹਾਂ ਅਤੇ ਤੁਸੀਂ ਮੈਨੂੰ ਥੋੜ੍ਹਾ ਦੱਸ ਦਿਉ ਕੀ ਇਹਦਾ ਹੁੰਦਾ ਤੁਹਾਡਾ ਕੀ ਹੈਗਾ ਅਤੇ ਉਹਦੀ ਰੈਟਿੰਗ ਬਾਰੇ ਮੈਂ ਫਿਰ ਤੁਹਾਨੂੰ ਕਰ ਦੇਵਾਂਗੀ ਅਤੇ ਇਹਦੇ ਬਾਰੇ ਕੋਈ ਜਾਣਕਾਰੀ ਹੋਰ ਹੋਏਗੀ ਤਾਂ ਮੈਨੂੰ ਦੱਸ ਦੇਣਾ